ਹਾਂ ਅਸੀਂ ਹੋਸਟਲ 'ਚ ਜਿਵੇਂ ਕਿ ਕਾਫੀ ਟਾਈਮ ਮੈਂ ਹੋਸਟਲ ਦੇ ਵਿੱਚ ਹੀ ਰਹੀ ਹਾਂ ਤਾਂ ਖਾਣਾ ਬਣਾਉਣ ਵੈਸੇ ਤਾਂ ਮੈਸ 'ਚ ਹੀ ਖਾਂਦੇ ਹਾਂ ਪਰ ਫੇਰ ਵੀ ਕਦੇ ਕਦੇ ਹੁੰਦਾ ਹੈ ਤਾਂ ਕੈਟਲ ਦੇ ਵਿੱਚ ਸੇਵੀਆਂ ਬਣਾਉਣੀਆਂ ਬੜੀਆਂ ਸੌਖੀਆਂ ਨੇ ਬਸ ਇੱਕ ਉਹਨਾਂ ਨੂੰ ਚਾਹੇ ਥੋੜ੍ਹਾ ਜਿਹਾ ਦੁੱਧ ਪਾਉ ਗਰਮ ਕਰੋ ਉਸ ਤੋਂ ਬਾਅਦ ਸੇਵੀਆਂ ਸੁੱਟ ਦਿਉ ਇੱਕ ਚਮਚ ਘਿਉ ਦਾ ਪਾ ਦਿਉ ਸ਼ੂਗਰ ਪਾ ਦਿਉ ਜੋ ਵੀ ਹੈ ਠੀਕ ਹੈ ਤਾਂ ਇਹ ਸੇਵੀਆਂ ਬਣਾਉਣੀਆਂ ਮੈਨੂੰ ਲੱਗਦਾ ਕਿ ਸਭ ਤੋਂ ਸੌਖੀਆਂ ਨੇ ਅਤੇ ਸਭ ਤੋਂ ਔਖਾ ਹੈ ਪਕਵਾਨ ਬਣਾਉਣਾ ਜੀ ਸਾਗ ਬਣਾਉਣਾ ਸਾਗ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਹਿਲਾਂ ਖੇਤ ਜਾਉ ਤੋੜ ਕੇ ਲਿਆਉ ਫਿਰ ਉਹਨੂੰ ਗੰਦਲਾਂ ਨੂੰ ਛਿੱਲੋ ਫਿਰ ਉਹਨੂੰ ਚੀਰੋ ਉਸ ਤੋਂ ਬਾਅਦ ਸਾਰਾ ਦਿਨ ਚੁੱਲ੍ਹੇ ਦੇ ਵਿੱਚ ਅੱਗ ਨੂੰ ਬਾਲੀ ਜਾਉ ਫਿਰ ਕਿਤੇ ਲਸਣ ਦੇ ਲਈ ਤੜਕੇ ਦੇ ਲਈ ਕਿੰਨੀਆਂ ਆਈਟਮਸ ਨੂੰ ਇਕੱਠੀਆਂ ਕਰੋ ਤਾਂ ਸਭ ਤੋਂ ਮੁਸ਼ਕਲ ਹੈ ਸਾਗ ਬਣਾਉਣਾ ਅਤੇ ਆਸਾਨ ਹੈ ਸੇਵੀਆਂ ਬਣਾਉਣਾ ਮੈਨੂੰ ਤਾਂ ਇਹੀ ਲੱਗਦਾ ਹੈ